ਹੈਲੋ ਹਾਂਜੀ ਹਾਂਜੀ ਜੀ ਗਲੋਬਲ ਵਾਰਮਿੰਗ ਦਾ ਤਾਂ ਅੱਜ ਕੱਲ੍ਹ ਬਹੁਤ ਹੀ ਬੁਰਾ ਹਾਲ ਹੈ ਤੁਹਾਨੂੰ ਪਤਾ ਹੀ ਹੈ ਫਸਲਾਂ ਕਿਵੇਂ ਖ਼ਰਾਬ ਹੋਣ ਡੀਆਂ ਹਾਂਜੀ ਹਾਂਜੀ ਜਿਵੇਂ ਪਿਛਲੇ ਸਾਲ ਕਾਫ਼ੀ ਹੜ੍ਹ ਆ ਗਏ ਸੀ ਫ਼ਸਲਾਂ ਸਾਰੀਆਂ ਖ਼ਰਾਬ ਹੋ ਗਈਆਂ ਸੀ ਹਾਂਜੀ ਹਾਂਜੀ ਜੀ ਅੱਜ ਕੱਲ੍ਹ ਦੇਖੋ ਜੀ ਜਿਵੇਂ ਗੜੇ ਮਾਰੀ ਹੈ ਪਿਛਲੇ ਦਿਨਾਂ 'ਚ ਹੀ ਪਈ ਹੈ ਇਹ ਵੀ ਬਹੁਤ ਨੁਕਸਾਨ ਦਾਇਕ ਹੈ ਫ਼ਸਲਾਂ ਖ਼ਰਾਬ ਹੁੰਦੀਆਂ ਪਈਆਂ ਸਾਡੀਆਂ ਤਾਂ ਤੁਸੀਂ ਆਪਣੀਆਂ ਸੁਣਾਓ ਤੁਹਾਡੇ ਵਾਲੇ ਪਾਸੇ ਕੀ ਹਾਲ ਹੈ ਤੁਹਾਡੀਆਂ ਫ਼ਸਲਾਂ ਦਾ ਹਾਂਜੀ ਜੀ ਇਹ ਤਾਂ ਹੈਗਾ ਜੀ ਇਹ ਤਾਂ ਹੁਣ ਕੀ ਕਰੀਏ ਕੁਦਰਤ ਦਾ ਕਹਿਰ ਹੈ ਜੀ ਉੱਪਰੋਂ ਲੋਕਾਂ ਨੇ ਜਿਹੜੀਆਂ ਜਿਹੜੀਆਂ ਇਹ ਨਵੇਂ ਅਵਿਸ਼ਕਾਰ ਹੈ ਜੀ ਇਹ ਸਾਡੇ ਖੇਤਾਂ ਅਤੇ ਫ਼ਸਲਾਂ ਲਈ ਬਹੁਤ ਹੀ ਮਾੜਾ ਪ੍ਰਭਾਵ ਪਾ ਰਿਹਾ ਹਾਂ ਹਾਂਜੀ ਹਾਂਜੀ ਹੋਰ ਐਤਕੀ ਫ਼ਸਲ ਵੀ ਘੱਟ ਹੋ ਰਹੀ ਹੈ ਇਹਨਾਂ ਕਾਰਨਾ ਕਰਕੇ ਕਿਉਂਕਿ ਗੜੇ ਪੈ ਗਏ ਆ ਇਸ ਨਾਲ ਸਾਡੀ ਫ਼ਸਲ ਬਹੁਤ ਘੱਟ ਫ਼ਰਕ ਪੈਣਾ ਵਾ ਅਗਰ ਪੈਦਾਵਾਰ 'ਚ ਅੱਗੇ ਪੈਦਾਵਾਰ ਜ਼ਿਆਦਾ ਹੁੰਦੀ ਹੈ ਅਸੀਂ ਹੁਣ ਬਸ ਇਦਾਂ ਹੀ ਆ ਕੀ ਕਰੀਏ ਹਾਂਜੀ ਜੀ ਇਹ ਹੀ ਹੈ ਨਾ ਇਹ ਗਲੋਬਲ ਵਾਰਮਿੰਗ ਫੈਲੀ ਹੈ ਇਹਦੇ ਨਾਲ ਫ਼ਸਲਾਂ ਨੂੰ ਨਹੀਂ ਹਰ ਚੀਜ਼ ਨੂੰ ਬਹੁਤ ਫ਼ਰਕ ਪੈਂਦਾ ਜੀ ਦੇਖੋ ਵਾਤਾਵਰਨ ਦੇ ਫ਼ਰਕ ਨਾਲ ਲੋਕਾਂ 'ਤੇ ਕਿੰਨਾ ਅਸਰ ਆ ਕਿੰਨੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਉਹ ਬਹੁਤ ਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਤਾਂ ਪਰ ਚਲੋ

ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਜੀ ਜੋ ਵੀ ਹੈ ਇੱਦਾਂ ਹੀ ਹੁਣ ਚੱਲਦਾ ਰਹਿਣਾ ਜੋ ਵੀ ਹੈ ਨਜਿੱਠਣੀ ਤਾਂ ਪੈਣੀ ਆ ਨਾ ਜੀ ਜੇ ਫ਼ਸਲ ਹੁਣ ਖ਼ਰਾਬ ਥੋੜ੍ਹੀ ਬਚਾਉਣ ਲਈ ਫ਼ਸਲਾਂ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਬਾਕੀ ਰੱਬ ਅੱਗੇ ਅਰਦਾਸ ਹੀ ਆ ਕਿ ਇਹ ਗਲੋਬਲ ਵਾਰ ਹੋਰ ਸਾਡੇ ਲੋਕਾਂ ਦੇ ਹੱਥ ਵੱਸ ਜਾਂ ਲੋਕ ਸਿਆਣੇ ਹੋ ਜਾਣ ਹਾਂਜੀ ਜਾਂ ਤਾਂ ਲੋਕਾਂ ਵੀ ਲੋਕ ਸਿਆਣੇ ਹੋ ਜਾਣ ਫਿਰ ਹੀ ਆ ਕੋਈ ਇਹਦਾ ਹੱਲ ਬਾਕੀ ਤਾਂ ਕੁਛ ਨਹੀਂ ਜੀ ਚਲੋ ਠੀਕ ਆ ਜੀ ਫਿਰ ਮਿਲਾ ਕਰਦੇ ਹਾਂ ਤੁਹਾਡੇ ਨਾਲ ਬਾਅਦ 'ਚ ਗੱਲ ਸ਼ੁਕਰੀਆ ਜੀ ਸ਼ੁਕਰੀਆ